ਸਿੱਖ ਸਿੱਖ ਧਰਮ ਦੇ ਵਿੱਚ ਸਮੱਸਿਆਵਾਂ ਅੱਜ ਕੱਲ੍ਹ ਬਹੁਤ ਖੜ੍ਹੀਆਂ ਹੋ ਗਈਆਂ ਜਿਵੇਂ ਸਾਡਾ ਪੰਜਾਬ ਸਿੱਖ ਧਰਮ ਹੈ ਇਹਦੇ ਵਿੱਚ ਲੋਕ ਹੋਰ ਇੱਧਰੋਂ ਉੱਧਰੋਂ ਆ ਕੇ ਜਿਵੇਂ ਹੋਰ ਧਰਮਾਂ ਦੇ ਲੋਕ ਉਹ ਕਹਿੰਦੇ ਵੀ ਸਾਡਾ ਧਰਮ ਅਪਣਾਉ ਇਹਦੇ ਕਰਕੇ ਸਿੱਖ ਧਰਮ ਨੂੰ ਬਹੁਤ ਜ਼ਿਆਦਾ ਚੁਣੌਤੀਆਂ ਆ ਰਹੀਆਂ